ਖੇਡਾਂ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਸਿੱਖਿਆ ਵਿੱਚ ਤਾਂ ਖੇਡਾਂ ਬਹੁਤ ਹੀ ਜ਼ਿਆਦਾ ਆਵਸ਼ਕ ਹਨ ਕਿਉਂਕਿ ਸਿੱਖਿਆ ਵਿੱਚ ਖੇਡ ਖੇਡਾਂ ਸਾਡੇ ਸਰੀਰ ਨੂੰ ਚੁਸਤ ਤੰਦਰੁਸਤ ਅਤੇ ਫੁਰਤੀਲਾ ਬਣਾਉਂਦੇ ਹਨ ਖੇਡਾਂ ਨਾਲ ਹੀ ਸਾਡਾ ਸਰੀਰ ਚੁਸਤ ਰਹਿੰਦਾ ਅਤੇ ਮਨ ਵੀ ਚੁਸਤ ਰਹਿੰਦਾ ਹੈ ਜੇਕਰ ਸਾਡਾ ਦਿਮਾਗ ਚ ਚੁਸਤ ਅਤੇ ਤੰਦਰੁਸਤ ਰਹਿੰਦਾ ਹੈ ਤਾਂ ਹੀ ਅਸੀਂ ਖੇਡਾਂ ਵਧੀਆ ਖੇਡ ਸਕਦੇ ਹਾਂ ਅਤੇ ਤਾਂ ਹੀ ਅਸੀਂ ਸਿੱਖਿਆ ਵਿੱਚ ਵੱਧ ਤੋਂ ਵੱਧ ਅੰਕ ਹਾਸਿਲ ਕਰ ਸਕਦੇ ਹਾਂ ਜੇਕਰ ਸਾਡੀਆਂ ਖੇਡਾਂ ਮਜ਼ਬੂਤ ਹਨ ਤਾਂ ਸਾਡਾ ਦਿਮਾਗ ਵੀ ਚੁਸਤ ਫੁਰਤੀਲਾ ਰਹੇਗਾ ਅਤੇ ਸਾਡੇ ਚੰਗੀ ਤਰ੍ਹਾਂ ਅਸੀਂ ਪੜ੍ਹਾਈ ਅਤੇ ਲਗਨ ਨਾਲ ਕੰਮ ਕਰ ਸਕਦੇ ਹਾਂ ਪੜ੍ਹਾਈ ਵਿੱਚ ਲਗਨ ਰੱਖਣ ਕਾਰਨ ਸਾਨੂੰ ਖੇਡਾਂ ਵੀ ਪੂਰੇ ਸਮੇਂ ਤਾਂ ਖੇਡਣੀਆਂ ਚਾਹੀਦੀਆਂ ਹਨ ਜਿਵੇਂ ਕਿ ਪੂਰੇ ਦਿਨ ਵਿੱਚ ਸਾਨੂੰ ਦੋ ਘੰਟੇ ਘੱਟੋ ਘੱਟ ਖੇਡਾਂ ਵਿੱਚ ਆਪਣੀ ਰੁਚੀ ਬਣਾਉਣੀ ਚਾਹੀਦੀ ਹੈ ਖੇਡਾਂ ਨਾਲ ਸਾਡਾ ਸ਼ਰੀ ਦਿਮਾਗ ਚੁਸਤ ਰਹੇਗਾ ਜਿਸ ਕਾਰਨ ਸਾਡਾ ਸਰੀਰ ਵੀ ਚੁਸਤ ਰਹੇਗਾ ਅਤੇ ਸਾਡਾ ਉਸ ਤੋਂ ਬਾਅਦ ਅਸੀਂ ਵੱਧ ਤੋਂ ਵੱਧ ਪੜ੍ਹਾਈ ਕਰ ਸਕਦੇ ਹਾਂ ਵੱਧ ਤੋਂ ਵੱਧ ਪੜ੍ਹਾਈ ਨਾਲ ਸਾਡਾ ਦਿਮਾਗ ਵੀ ਵੱਧ ਵਿਕਸਿਤ ਹੋਵੇਗਾ ਅਤੇ ਵੱਧ ਵਿਕਸਿਤ ਹੋਣ ਕਰਕੇ ਸਾਡਾ ਅੱਗੇ ਵੱਧ ਵੱਧ ਸਾਨੂੰ ਵਧੀਆ ਸਾਨੂੰ ਉਪਲੱਬਧੀਆਂ ਹਾਸਿਲ ਹੋਣਗੀਆਂ ਬਹੁਤ ਸਾਰੇ ਖਿਡਾਰੀ ਵੀ ਹਨ ਜਿਹਨਾਂ ਨੇ ਬਹੁਤ ਜ਼ਿਆਦਾ ਨਾਮ ਬਾ ਭਾਰਤ ਦਾ ਰੋਸ਼ਨ ਕੀਤਾ ਹੈ ਜਿਵੇਂ ਕਿ ਵਿਰਾਟ ਕੋਹਲੀ ਹੋ ਗਿਆ ਉਹਨੇ ਖੇਡਾਂ ਖੇਡ ਵਿਚ ਜਿਵੇਂ ਕਿ ਕ੍ਰਿਕਟ ਵਿੱਚ ਉਹਨੇ ਕਾਫ਼ੀ ਉੱਚਾ ਉੱਚੀ ਪਦਵੀ ਹਾਸਿਲ ਕੀਤੀ ਹੈ ਅਤੇ ਅੱਜ ਦੁਨੀਆਂ ਦਾ ਹਰ ਖਿਡਾਰੀ ਉਸ ਨੂੰ ਜਾਣਦਾ ਹੈ ਖੇਡਾਂ ਇਸ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਕਿਉਂਕਿ ਸਾਡਾ ਬਹੁਤ ਜ਼ਿਆਦਾ ਦਿਮਾਗ ਫੁਰਤੀਲਾ ਰਹਿੰਦਾ ਅਤੇ ਸਾਡਾ ਸਰੀਰ ਨੂੰ ਵੀ ਕੋਈ ਰੋਗ ਨਹੀਂ ਲੱਗਦਾ